ਤੇਈ ਨਵੰਬਰ ਉੱਨੀ ਸੌ ਸਤਾਸੀ ਚੌਦਾਂ ਅਪ੍ਰੈਲ ਦੋ ਹਜ਼ਾਰ ਪੰਦਰਾਂ ਪੰਦਰਾਂ ਅਪ੍ਰੈਲ ਉੱਨੀ ਸੌ ਇਕਾਹਠ ਇੱਕ ਸਤੰਬਰ ਉੱਨੀ ਸੌ ਛਿਆਸੀ ਬਾਈ ਅਗਸਤ ਦੋ ਹਜ਼ਾਰ ਤੇਈ